ਆਰਟਿਸਟ ਵੈਨ ਗੋਕ ਦੀ ਇੱਕ ਬਹੁਤ ਸੋਹਣੀ ਪੇਂਟਿੰਗ ਹੈ ਜਿਸਦਾ ਨਾਮ ਆ ਸਟਾਰੀ ਨਾਈਟਸ ਇਸ ਦੀਆਂ ਬਹੁਤ ਸਾਰੀਆਂ ਰੈਪਲੀਕਾਜ ਵੀ ਸਾਨੂੰ ਗੂਗਲ 'ਤੇ ਜਾਂ ਹੋਰ ਪੇਂਟਿੰਗ ਸਟੋਰਜ਼ 'ਤੇ ਮਿਲ ਜਾਂਦੀਆਂ ਨੇ ਇਹ ਆਰਟ ਜਿਹੜੀ ਹੈ ਇਸ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ ਕਿਉਂਕਿ ਆਰਟ ਦੇ ਅੰਦਰ ਬਹੁਤ ਜ਼ਿਆਦਾ ਹਿਡਨ ਮੈਸੇਜਿਸ ਵੀ ਨੇ ਅਤੇ ਜੇ ਤੁਸੀਂ ਉਸ ਆਰਟ ਨੂੰ ਦੇਖੋਂਗੇ ਤਾਂ ਇੰਨੀ ਬਰੀਕੀ ਨਾਲ ਉਸ ਨੂੰ ਬਣਾਇਆ ਗਿਆ ਹੈ ਕਿ ਤੁਸੀਂ ਮਤਲਬ ਤੁਸੀਂ ਅਸਚਰਜ ਜਨਕ ਹੋ ਜਾਵੋਂਗੇ ਕਿ ਆਹ ਬੰਦੇ ਨੇ ਕੀ ਸੋਚ ਕੇ ਇੰਨੇ ਸੋਹਣੇ ਕੋਂਬੀਨੇਸ਼ਨ ਬਣਾਏ ਨੇ ਜਾਂ ਕੀ ਸੋਚ ਕੇ ਉਸਨੇ ਇਸ ਤਰੀਕੇ ਨਾਲ ਉਸ ਆਰਟ ਨੂੰ ਬਣਾਇਆ ਤਾਂ ਮੈਨੂੰ ਬਹੁਤ ਹੀ ਸੋਹਣੀ ਲੱਗੀ ਉਹ ਆਰਟ ਦੇਖਣ 'ਚ ਉਸ ਤੋਂ ਇਲਾਵਾ ਜੇ ਗੱਲ ਕਰਾਂ ਕਿ ਮੈਨੂੰ ਕਿਸ ਤਰੀਕੇ ਦਾ ਜਿਹੜਾ ਆਰਟ ਹੈ ਉਹ ਦੇਖਣਾ ਪਸੰਦ ਹੈ ਤਾਂ ਮੈਨੂੰ ਹਰ ਤਰੀਕੇ ਦਾ ਹੀ ਆਰਟ ਦੇਖਣਾ ਪਸੰਦ ਹੈ ਕਿਉਂਕਿ ਜਿਹੜਾ ਆਰਟ ਹੈ ਉਹ ਉਹ ਕਹਿ ਲਓ ਕਿ ਸਾਡੀ ਜ਼ਿੰਦਗੀ ਹੀ ਆਰਟ ਹੈ ਤਾਂ ਆਰਟ ਦੇ ਦੁਆਰਾ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਤੁਸੀਂ ਖੁਸ਼ ਫੀਲ ਕਰਦੇ ਹੋ ਜਾ ਤੁਸੀਂ ਕੁਛ ਵੀ ਆਰਟਿਸਟਿਕ ਦੇਖਦੇ ਹੋ ਜਿਵੇਂ ਕਿ ਕੋਈ ਬੰਦਾ ਕਿਸੇ ਚੀਜ਼ ਨੂੰ ਪੇਂਟ ਕਰ ਰਿਹਾ ਹੈ ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਪੁਰਾਣੇ ਤੋਂ ਨਵਾਂ ਬਣਾ ਰਿਹਾ ਆਰਟ ਦੇ ਥਰੂ ਜਾਂ ਅੱਜ ਕੱਲ੍ਹ ਜਿਵੇਂ ਨੇਲ ਆਰਟ ਚੱਲਿਆ ਹੋਇਆ ਉਹਦੇ ਵਿੱਚ ਵੀ ਮੈਂ ਬਹੁਤ ਇੰਟਰਸਟਿਡ ਹਾਂ ਮੈਂ ਉਹ ਵੀ ਸਿੱਖ ਰਹੀ ਹਾਂ ਅਤੇ ਬਸ ਆਰਟ ਕੁਛ ਐਸੀ ਚੀਜ਼ ਹੈ ਕਿ ਤੁਸੀਂ ਜੋ ਮਰਜ਼ੀ ਬੰਦੇ ਨੂੰ ਕਰਦੇ ਦੇਖ ਲਓ ਐਜ ਐਨ ਆਰਟਿਸਟ ਉਹ ਖੂਬਸੂਰਤ ਲੱਗਦਾ ਹੈ ਅਤੇ ਬਹੁਤ ਚੰਗਾ ਲੱਗਦਾ ਮਨ ਨੂੰ